ਹੈਲੋ ਤੁਸੀ ਸ਼ਗੁਨ ਢਾਬੇ ਤੋਂ ਬੋਲਦੇ ਹੋ ਮੈਨੂੰ ਆਪਣੇ ਘਰ ਨਾ ਕੱਲ੍ਹ ਦੇ ਫੰਕਸ਼ਨ ਵਾਸਤੇ ਨਾ ਥੋੜ੍ਹੇ ਆਈਟਮਸ ਚਾਹੀਦੇ ਸੀਗੇ ਕੀ ਤੁਹਾਡੇ ਕੋਲ ਦਾਲ ਮੱਖਣੀ ਅਤੇ ਸ਼ਾਹੀ ਪਨੀਰ ਅਤੇ ਸੌ ਬੰਦਿਆਂ ਦੀ ਫੁਲਕਾ ਤੰਦੂਰੀ ਫੁਲਕਾ ਚਾਹੀਦਾ ਹੈ ਤਿਆਰ ਹੋ ਜਾਵੇਗਾ ਕੱਲ੍ਹ ਗਿਆਰਾਂ ਵਜੇ ਤੱਕ ਰੋਟੀ ਚਾਹੀਦੀ ਹੈ ਅਤੇ ਮਸਾਲੇ ਵਗੈਰਾ ਘੱਟ ਰੱਖਣੇ ਹੈ ਮੈਂ ਬੜਾ ਨਾਂ ਸੁਣਿਆ ਸੀਗਾ ਤੁਹਾਡਾ ਸ਼ਗੁਨ ਢਾਬੇ ਦਾ ਕਿ ਤੁਸੀਂ ਰੋਟੀ ਵਗੈਰਾ ਘਰ ਵੀ ਡਿਲੀਵਰ ਕਰ ਦਿੰਦੇ ਹੋ ਅਤੇ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਮੈਨੂੰ ਦੱਸ ਦਿਉ ਕਿ ਕਿੰਨੀ ਕੁ ਦੀ ਪਏਗੀ ਮੈਨੂੰ ਇਹ ਰੋਟੀ ਉਹਨਾਂ ਦੀ ਅਤੇ ਮੈਂ ਤੁਹਾਨੂੰ ਪੇਮੈਂਟ ਫੇਰ ਆਰਡਰ ਮੇਰਾ ਨੋਟ ਕਰ ਲਉ ਮੇਰਾ ਨਾਮ ਪ੍ਰੀਤੀ ਹੈ ਅਤੇ ਫ਼ੋਨ ਨੰਬਰ ਮੇਰਾ ਇਹੀ ਓ ਲਿਖ ਲਿਉ ਅਤੇ ਮੈਂ ਤੁਹਾਨੂੰ ਪੇਮੈਂਟ ਆਪਣਾ ਨੰਬਰ ਸੈਂਡ ਕਰ ਦਿਉ ਮੈਂ ਗੂਗਲ ਰਾਹੀਂ ਤੁਹਾਨੂੰ ਪੇਮੈਂਟ ਕਰ ਦੇਵਾਂਗੀ ਅਤੇ ਸਬਜ਼ੀ 'ਚ ਨਾ ਜਿਹੜਾ ਤੁਸੀਂ ਦਾਲ ਮੱਖਣੀ ਬਣਾਉਣੀ ਹੈ ਮਿਰਚਾਂ ਘੱਟ ਰੱਖਿਉ ਸ਼ਾਹੀ ਪਨੀਰ 'ਚ ਘਿਉ ਦਾ ਜ਼ਿਆਦਾ ਤੜਕਾ ਨਹੀਂ ਲਾਉਣਾ ਬਸ ਇਹੀ ਸਾਰਾ ਤੁਸੀਂ ਧਿਆਨ ਰੱਖਣਾ ਹੈ ਰੋਟੀ ਨਰਮ ਹੋਣੀ ਚਾਹੀਦੀ ਹੈ ਮੱਖਣ ਉੱਤੇ ਲਗਾ ਕੇ ਦਿਉ